ਪਹਿਲੀ ਭਾਰਤੀ ਕਲਾ ਜੋ ਕਿ ਹੈ ਕਢਾਈ ਬੁਣਾਈ ਇਹ ਕਲਾ ਸ਼ੈਲੀ ਬਿਲੁਕਤ ਹੁੰਦੀ ਜਾਂਦ ਜਾਂਦੀ ਪਈ ਹੈ ਜਿਸਨੂੰ ਰੋਕਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਕਢਾਈ ਬੁਣਾਈ ਨਾਲ ਅਸੀਂ ਕਈ ਪ੍ਰਕਾਰ ਦੇ ਆਪ ਡਿਜਾਇਨ ਕੀਤੇ ਹੋਏ ਚਾਦਰਾਂ ਕੋਈ ਸਰੈਣੇ ਔਰ ਕਈ ਚਿੱਤਰਕਲਾ ਉਹਨਾਂ ਤੋਂ ਬਣਾ ਸਕਦੇ ਹਾਂ ਜੋ ਕਿ ਦੇਖਣ ਵਿੱਚ ਬਹੁਤ ਹੀ ਸੋਹਣੀ ਲੱਗਦੀਆਂ ਹਨ ਔਰ ਅਸੀਂ ਕਈ ਐਵੇਂ ਦੇ ਕਢਾਈ ਬਣਾਈ ਦੀਆਂ ਚੀਜ਼ਾਂ ਬਣਾਉਂਦੇ ਹਾਂ ਜੋ ਕਿ ਕਈ ਸਮਾਨ ਢੱਕਣ ਦੇ ਕੰਮ ਆਉਂਦੀਆਂ ਹਨ ਜਿਵੇਂ ਕਿ ਕੋਈ ਅੰਗੀਠੀ ਉੱਤੇ ਰੱਖਣ ਵਾਲੀ ਕੋਈ ਕਢਾਈ ਬੁਣਾਈ ਦੀ ਚੀਜ਼ ਕੋਈ ਸ਼ੀਸ਼ੇ ਦੇ ਉੱਤੇ ਟੰਗਣ ਵਾਲੀ ਕਢਾਈ ਬੁਣਾਈ ਦੀ ਚੀਜ਼ ਇਹ ਸਾਡੇ ਰੋਜ਼ਾਨਾ ਵਰਤੋਂ ਦੇ ਬਹੁਤ ਹੀ ਕੰਮ ਆਉਂਦੀ ਹੈ ਦੂਜੀ ਕਲਾ ਸ਼ੈਲੀ ਜੋ ਕਿ ਹੈ ਪੱਖੀਆਂ ਬਣਾਉਣ ਦੀ ਕਲਾ ਸ਼ੈਲੀ ਜੋ ਕਿ ਅੱਜ ਦੇ ਸਮੇਂ ਵਿੱਚ ਪੰਜਾਬ ਵਿੱਚ ਬਿਲਕੁਲ ਹੀ ਵਿਲੁਪਤ ਹੁੰਦੀ ਜਾਂਦੀ ਪਈ ਹੈ ਕਿਉਂਕਿ ਲੋਕ ਏਸੀ ਅਤੇ ਪੱਖਿਆਂ ਦੇ ਸਹਾਰੇ ਰਹਿੰਦੇ ਹਨ ਔਰ ਇਨਵਰਟਰ ਆ ਚੁੱਕੇ ਹਨ ਜਿਹਨਾਂ ਕਰਕੇ ਕਿ ਬਿਜਲੀ ਜਾਣ ਦੇ ਬਾਅਦ ਵੀ ਕੋਈ ਪ੍ਰਭਾਵ ਨਹੀਂ ਪੈਂਦਾ ਔਰ ਇਹ ਕਲਾ ਬਿਲਕੁਲ ਹੀ ਵਿਲੁਪਤ ਹੁੰਦੀ ਜਾ ਰਹੀ ਹੈ ਤੀਸਰੀ ਕਲਾ ਅਸੀਂ ਕਹਿ ਸਕੀਏ ਤਾਂ ਹੈ ਟੋਕਰੀ ਬੁਣਾਈ ਦੀ ਕਲਾ ਜੋ ਕਿ ਸਾਡੀ ਭਾਰਤ ਵਿੱਚ ਬਿਲਕੁਲ ਹੀ ਵਿਲੁਪਤ ਹੁੰਦੀ ਜਾ ਰਹੀ ਹੈ ਲੋਕ ਇਸ ਨੂੰ ਜ਼ਿਆਦਾ ਵਰਤੋਂ ਵਿੱਚ ਨਹੀਂ ਲੈ ਕੇ ਆ ਰਹੇ ਇਸ ਦੀ ਜਗ੍ਹਾ ਕੋਈ ਸਟੀਲ ਜਾਂ ਫਿਰ ਕੋਈ ਪਲਾਸਟਿਕ ਦੇ ਬਰਤਨ ਯੂਜ ਕਰ ਰਹੇ ਹਨ ਜੋ ਕਿ ਪਸ਼ੂਆਂ ਨੂੰ ਚਾਰਾ ਪਾਉਣ ਦੇ ਕੰਮ ਆ ਰਹੇ ਹਨ ਚੌਥੀ ਕਲਾ ਕਹਿ ਸਕੀਏ ਤਾਂ ਚਿੱਤਰਕਲਾ ਹੈ ਜੋ ਕਿ ਅੱਜ ਦੇ ਸਮੇਂ ਵਿੱਚ ਭਾਰਤ ਵਿੱਚ ਵਿਲੁਪਤ ਹੁੰਦੀ ਜਾ ਰਹੀ ਹੈ ਔਰ ਲੋਕ ਇਸ ਨੂੰ ਜ਼ਿਆਦਾ ਮਹੱਤਤਾ ਨਹੀਂ ਦੇ ਰਹੇ ਹਨ ਔਰ ਜ਼ਿਆਦਾ ਤੋਂ ਜ਼ਿਆਦਾ ਆਪਣਾ ਸਮਾਂ ਬਾਕੀ ਬੇਕਾਰ ਚੀਜ਼ਾਂ 'ਤੇ ਲਗਾਉਂਦੇ ਜਾ ਰਹੇ ਹਨ ਫਿਫਥ ਐਂਡ ਲਾਸਟ ਕਲਾ ਜੋ ਕਿ ਹੈ ਲੋਕ ਨਾਚ ਦੀ ਕਲਾ ਇਹ ਵੀ ਸਾਡੇ ਭਾਰਤ ਵਿੱਚ ਦਿਨ ਬ ਦਿਨ ਵਿਲੁਪਤ ਹੁੰਦੀ ਜਾ ਰਹੀ ਹੈ ਕਿਉਂਕਿ ਲੋਕ ਆਪਣੇ ਸੱਭਿਆਚਾਰਕ ਡਾਂਸ ਔਰ ਨਰਿਤਿਯ ਨੂੰ ਭੁੱਲਦੇ ਜਾ ਰਹੇ ਹਨ ਅਤੇ ਪੱਛਮੀ ਦੇਸ਼ਾਂ ਦੇ ਸੰਗੀਤਾਂ ਦੇ ਪ੍ਰਤੀ ਜ਼ਿਆਦਾ ਆਪਣਾ ਇੰਟਰਸਟ ਦਿਖਾ ਰਹੇ ਹਨ ਜਿਸ ਕਰਕੇ ਸਾਡੇ ਲੋਕ ਨਾਚ ਦੀ ਕਲਾ ਵੀ ਵਿਲੁਪਤ ਹੁੰਦੀ ਜਾ ਰਹੀ ਹੈ ਜਿਸ ਨੂੰ ਰੋਕਣਾ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ ਤਾਂ ਕਿ ਸਾਡੇ ਦੇਸ਼ ਦਾ ਨਾਮ ਉੱਤੇ ਕਰ ਸਕੀਏ ਇਹਨਾਂ ਸਾਰੀਆਂ ਲੋਕ ਕਲਾ ਸ਼ੈਲੀਆਂ ਨੂੰ ਸਾਨੂੰ ਬਚਾਉਣਾ ਚਾਹੀਦਾ ਹੈ ਤਾਂ ਕਿ ਸਾਡਾ ਦੇਸ਼ ਵੀ ਬਾਕੀ ਦੇਸ਼ ਵਾਂਗ ਮਹਾਨ ਬਣੇ ਔਰ ਅਸੀਂ ਆਪਣਾ ਸੱਭਿਆਚਾਰ ਸਾਰਿਆਂ ਨੂੰ ਦੱਸ ਸਕੀਏ ਧੰਨਵਾਦ